ਸਤਿ ਸ਼੍ਰੀ ਅਕਾਲ ਮੈਂ ਪ੍ਰਿਆ ਜੇਕਰ ਮੈਂ ਅੱਜ ਤੁਹਾਡੇ ਨਾਲ ਗੱਲ ਕਰਾਂ ਪ੍ਰੋਜੈਕਟਾਂ ਲਈ ਰੰਗਾਂ ਦੀ ਚੁਣਾਵ ਦੀ ਤਾਂ ਅੱਜ ਕੱਲ ਸ਼ੋਸ਼ਲ ਮੀਡੀਆ 'ਤੇ ਬਹੁਤ ਹੀ ਇਸ ਦਾ ਟ੍ਰੈਂਡ ਹੈਗਾ ਸ਼ੋਸ਼ਲ ਮੀਡੀਆ 'ਤੇ ਬਹੁਤ ਹੀ ਵਧੀਆ ਵਧੀਆ ਤਰ੍ਹਾਂ ਦੇ ਕੰਟਰਾਸਟ ਆਏ ਹੁੰਦੇ ਹਨ ਬਹੁਤ ਸਾਰੇ ਪੇਜਿਸ ਹਨ ਜਿਨ੍ਹਾਂ 'ਤੇ ਲੋਕ ਆਪਣੇ ਸੋਹਣੇ ਸੋਹਣੇ ਸੂਟ ਨੂੰ ਸਿਲਵਾ ਕੇ ਉਹਨਾਂ ਨੂੰ ਅਪਲੋਡ ਕਰਦੇ ਹਨ ਮੈਂ ਇਹਨਾਂ ਸਾਰੇ ਸ਼ੋਸ਼ਲ ਮੀਡੀਆ ਅਕਾਊਂਟਸ ਨੂੰ ਫੋਲੋ ਕਰਦੀ ਹਾਂ ਅਤੇ ਉਹਨਾਂ ਤੋਂ ਕੁਝ ਜੋ ਮੈਨੂੰ ਆਕਰਸ਼ਿਤ ਲੱਗਦੇ ਹਨ ਉਹਨਾਂ ਨੂੰ ਮੈਂ ਨੋਟ ਕਰਕੇ ਰੱਖਦੀ ਹਾਂ ਅਤੇ ਟ੍ਰੈਂਡ ਦੇ ਹਿਸਾਬ ਨਾਲ ਜੋ ਅੱਜ ਨਵਾਂ ਆਇਆ ਹੈ ਉਸ ਨੂੰ ਵੀ ਨੋਟ ਕਰਕੇ ਰੱਖਦੀ ਹਾਂ ਅਤੇ ਜਦੋਂ ਵੀ ਮੇਰੇ ਕੋਲ ਕੋਈ ਨਵਾਂ ਪ੍ਰੋਜੈਕਟ ਆਉਂਦਾ ਹੈ ਤਾਂ ਮੈਂ ਆਪਣੇ ਕਸਟਮਰ ਨੂੰ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਝਾਵ ਦਿੰਦੀ ਹਾਂ ਆਇਡੀਆ ਦਿੰਦੀ ਹਾਂ ਅਤੇ ਉਹਨਾਂ ਨੂੰ ਬਹੁਤ ਹੀ ਪਸੰਦ ਆਉਂਦੇ ਹਨ ਅਤੇ ਜੇਕਰ ਮੈਂ ਗੱਲ ਕਰਾਂ ਆਪਣੇ ਮਸ ਆਪਣੇ ਮਨਪਸੰਦੀਦਾ ਰੰਗਾਂ ਦੀ ਤਾਂ ਉਹਨਾਂ ਵਿੱਚ ਕੁਝ ਚੋਣਵੇਂ ਰੰਗ ਹਨ ਜਿਵੇਂ ਕਿ ਪੀਲਾ ਮਰਜੈਂਟਾ ਕਾਲਾ ਅਤੇ ਗੁਲਾਬੀ ਇਹ ਸਾਰੇ ਜਿਹੜੇ ਹਨ ਮੇਰੇ ਮਨਪਸੰਦੀਦਾ ਰੰਗ ਹਨ